ਸਾਡੇ ਸਥਾਨਕ ਖੇਤਰ ਵਿੱਚ ਲਗਭਗ ਸਾਰੀਆਂ ਹੀ ਕੰਪਨੀਆਂ ਵੱਲੋਂ ਆਪਣੇ ਡਾਟਾ ਪਲੈਨ ਨਾਲ ਗਾਹਕਾਂ ਨੂੰ ਆਕਰਸ਼ਿਤ ਕੀਤਾ ਜਾਂਦਾ ਹੈ ਮੁੱਖ ਤੌਰ 'ਤੇ ਇਹਨਾਂ ਵਿੱਚ ਜੀਓ ਏਅਰਟੈਲ ਅਤੇ ਵੋਡਾਫੋਨ ਆਈਡੀਆ ਆਦਿ ਸ਼ਾਮਿਲ ਹਨ ਸਾਡੇ ਵੱਲੋਂ ਏਅਰਟੈਲ ਨੈਟਵਰਕ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ ਕਿਉਂਕਿ ਇਸ ਵਿੱਚ ਨੈਟਵਰਕ ਦੀ ਕੋਈ ਸਮੱਸਿਆ ਨਹੀਂ ਆਉਂਦੀ ਅਤੇ ਸਾਡੇ ਸਥਾਨਕ ਏਰੀਏ ਵਿੱਚ ਸੰਬੰਧਿਤ ਕੰਪਨੀ ਦਾ ਟਾਵਰ ਵੀ ਲੱਗਾ ਹੋਇਆ ਹੈ ਅਤੇ ਇਸ ਲਈ ਸਾਨੂੰ ਇਹ ਅਤੇ ਡਾਟਾ ਜਿਹੜਾ ਉਹ ਇੱਕ ਸਪੀਡ ਨਾਲ ਮਿਲਦਾ ਹੈ ਅਤੇ ਇਸ ਦੀ ਵਰਤੋਂ ਆਪਾਂ ਆਪਣੇ ਰੋਜ਼ਾਨਾ ਦੇ ਕੰਮਾਂਕਾਰਾਂ ਵਿੱਚ ਕਰ ਸਕਦੇ ਹਾਂ ਜਿਸ ਤਰ੍ਹਾਂ ਕਿ ਕੋਈ ਸਾਨੂੰ ਅਸਾਈਨਮੈਂਟ ਡਾਊਨਲੋਡ ਕਰਨੀ ਹੋਵੇ ਉਸ ਦੇ ਉੱਪਰ ਕਿਸੇ ਪ੍ਰੋਜੈਕਟ 'ਤੇ ਕੰਮ ਕਰਨਾ ਹੈ ਅਤੇ ਉਸ ਤੋਂ ਇਲਾਵਾ ਸੋਸ਼ਲ ਮੀਡੀਆ ਅਤੇ ਫੇਸਬੁਕ ਯੂਟਿਊਬ ਆਦਿ ਦੀ ਵਰਤੋਂ ਵਿੱਚ ਵੀ ਇਹ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਸ ਲਈ ਸਾਡੇ ਵੱਲੋਂ ਇਸ ਕੰਪਨੀ ਦੇ ਡਾਟਾ ਪਲਾਨ ਦੀ ਵਰਤੋਂ ਕੀਤੀ ਗਈ ਹੈ